ਡਿਜੀਟਲ ਕਲਾ ਅੱਜ ਦੀ ਇਸ ਸਮੇਂ ਦੇ ਵਿੱਚ ਹਰੇਕ ਪੱਧਰ 'ਤੇ ਡਿਜੀਟਲ ਚੀਜ਼ਾਂ ਦਾ ਇਸਤੇਮਾਲ ਹੋ ਰਿਹਾ ਮਨੁੱਖ ਮਨੁੱਖ ਦੁਆਰਾ ਬਣਾਈ ਗਈ ਕੋਈ ਵੀ ਚੀਜ਼ ਨੂੰ ਡਿਜੀਟਲ ਤਰੀਕੇ ਨਾਲ ਬਣਾਈ ਗਈ ਚੀਜ਼ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਡਿਜੀਟਲ ਕਲਾ ਹੈ ਉਹ ਮਨੁੱਖ ਨੇ ਹੀ ਬਣਾਈ ਹੈ ਮਨੁੱਖ ਨੇ ਆਪਣੀਆਂ ਚੀਜ਼ਾਂ ਨੂੰ ਤੌਰ ਤਰੀਕੇ ਨੂੰ ਆਸਾਨ ਕਰਨ ਲਈ ਡਿਜੀਟਲ ਸ਼ਬਦ ਦਾ ਇਸਤੇਮਾਲ ਕੀਤਾ ਅੱਜ ਕੱਲ੍ਹ ਲੋਕ ਹੱਥੋਂ ਕਰਨ ਕੁਝ ਵੀ ਕੰਮ ਕਰਨ ਦੇ ਵਿੱਚ ਥੋੜ੍ਹਾ ਜਿਹਾ ਆਲਸ ਦਿਖਾਉਂਦੇ ਨੇ ਕਿ ਇਹ ਮੈਨੂੰ ਇਹ ਹੱਥੋਂ ਕਰਨਾ ਪੈਣਾ ਜਾਂ ਇਹ ਚੀਜ਼ ਕਰਨੀ ਪਏਗੀ ਅਤੇ ਇਸ ਤੋਂ ਵਧੀਆ ਕਿਉਂ ਨਾ ਆਨਲਾਈਨ ਹੀ ਕੋਈ ਨਾ ਕੋਈ ਚੀਜ਼ ਪਰਚੇਜ ਕਰ ਲਈ ਜਾਵੇ ਜਾਂ ਆਨਲਾਈਨ ਡਿਜੀਟਲ ਜਿਹੜੀਆਂ ਅੱਜ ਕੱਲ੍ਹ ਪੇਂਟਿੰਗ ਮਿਲਦੀਆਂ ਤਾਂ ਉਹਨਾਂ ਦਾ ਕਿਉਂ ਨਾ ਇਸਤੇਮਾਲ ਕਰ ਲਿਆ ਜਾਵੇ ਜਾਂ ਹੋਰ ਵੱਖ ਵੱਖ ਚੀਜ਼ਾਂ ਤੱਕ ਆਪਾਂ ਕਹਿ ਸਕਦੇ ਹਾਂ ਇਸ ਲਈ ਸਾਨੂੰ ਮਨੁੱਖ ਦੁਆਰਾ ਬਣਾਈ ਗਈ ਕੋਈ ਚਿੱਤਰਕਾਰੀ ਅਤੇ ਡਿਜੀਟਲ ਚਿੱਤਰਕਾਰੀ ਦੋਨੇ ਦੋਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਦੋਨੇ ਆਪਣੀ ਜਗ੍ਹਾ 'ਤੇ ਅਲੱਗ ਅਲੱਗ ਹਨ ਅਤੇ ਅਸੀਂ ਉਹ ਸਾਡਾ ਸਮੇਂ ਤਾਂ ਬਚਾ ਸਕਦੀ ਹੈ ਪਰ ਜਿਹੜਾ ਹੱਥ ਦੀ ਨਿਕਾਸੀ ਹੈ ਉਹਨੂੰ ਡਿਜੀਟਲੀ ਤੁਸੀਂ ਨਹੀਂ ਕਰ ਸਕਦੇ ਅਤੇ ਇਸ ਲਈ ਸਾਨੂੰ ਮੇਰੇ ਮੇਰੇ ਅਕੋਡਿੰਗ ਡਿਜੀਟਲ ਕਲਾ ਨੂੰ ਮੈਂ ਘੱਟ ਪਸੰਦ ਕਰੁੰਗੀ ਅਤੇ ਮੈਨੂੰ ਮਨੁੱਖ ਦੇ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਅੱਜ ਦੇ ਟਾਈਮ 'ਤੇ ਉਹ ਜ਼ਿਆਦਾ ਪਸੰਦ ਹਨ ਧੰਨਵਾਦ